ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਮੀਨਾਕਸ਼ੀ ਪਠਾਨਕੋਟ ਤੋਂ ਬੋਲ ਰਹੀ ਹਾਂ ਮੈਂ ਪਠਾਨਕੋਟ ਦੇ ਇੱਕ ਨਿੱਕੇ ਜਿਹੇ ਪਿੰਡ ਢੇਸੀਆਂ ਵਿੱਚ ਰਹਿੰਦੀ ਹਾਂ ਜਿਸ 'ਚ ਰਹਿੰਦੀ ਹਾਂ ਜਿਸ ਕਰਕੇ ਸਾਡੇ ਪਿੰਡ ਵਿੱਚ ਆਵਾਜਾਈ ਦੇ ਸਾਧਨਾਂ ਦੀ ਬਹੁਤ ਤੰਗੀ ਹੈ ਲੋਕਾਂ ਨੂੰ ਆਉਣ ਜਾਣ ਲਈ ਬਹੁਤ ਤੰਗੀ ਹੁੰਦੀ ਹੈ ਸਾਡੇ ਪਿੰਡ ਵਿੱਚ ਪਿੰਡ ਦੇ ਪਠਾਨਕੋਟ ਵਿੱਚ ਇੱਕ ਹੀ ਬੱਸ ਸਟੈਂਡ ਹੈ ਜਿਸ ਕਰਕੇ ਲੋਕਾਂ ਨੂੰ ਉੱਥੋਂ ਤੱਕ ਜਾਣ ਲਈ ਬਹੁਤ ਹੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਜਿਹਨਾਂ ਕੋਲ ਆਪਣੇ ਸਾਧਨ ਹੁੰਦੇ ਹਨ ਉਹ ਤਾਂ ਚਲੇ ਜਾਂਦੇ ਹਨ ਲੇਕਿਨ ਸਾਡੇ ਕਈ ਲੋਕਾਂ ਕੋਲ ਜਿਹਨਾਂ ਕੋਲ ਸਾਧਨ ਦੀ ਬਹੁਤ ਤੰਗੀ ਆ ਉਹਨਾਂ ਨੂੰ ਬਹੁਤ ਹੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਪਿੰਡ ਵਿੱਚ ਇਹਨਾਂ ਸਾਰੀ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ ਅਤੇ ਆਟੋ ਰਿਕਸ਼ਾ ਵਗੈਰਾ ਜਾਂ ਬੱਸ ਲਗਾਉਣੀ ਚਾਹੀਦੀ ਹੈ ਇਹਨਾਂ ਇਹਨਾਂ ਇਹਨਾਂ ਵਿਕਲਪਾਂ ਨੂੰ ਸਹੀ ਕਰਨ ਲਈ ਸਾਨੂੰ ਸਾਧਨਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਅਤੇ ਜਿਹਨਾਂ ਕੋਲ ਸਾਧਨ ਨਹੀਂ ਹੈ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇਹ ਸਾਰੇ